ਭਾਈ ਮੇਰਾ ਬਿਜਲੀ ਦਾ ਬਿੱਲ ਗਲਤ ਕਿਸੇ ਦੇ ਘਰ ਪਹੁੰਚਾਇਆ ਜਾਂਦਾ ਮੇਰੇ ਘਰ ਗੁਰਮੀਤ ਕੌਰ ਦੇ ਨਾਂ 'ਤੇ ਭੇਜ ਦਿੱਤਾ ਜਾਵੇ ਉਹ ਜੀ ਮੈਨੂੰ ਦਿੱਕਤ ਆਉਂਦੀ ਆ ਫਿਰ ਮੇਰੇ ਤੋਂ ਭਰਿਆ ਨਹੀਂ ਜਾਂਦਾ ਫਿਰ ਮੈਨੂੰ ਵੱਧ ਖਰਚਾ ਪੈਂਦਾ ਫਿਰ ਮੈਂ ਕਿਸੇ ਦੇ ਘਰ ਮੰਗਣ ਜਾਂਦੀ ਹਾਂ ਫਿਰ ਅਗਲਾ ਗੁੱਸੇ ਹੁੰਦਾ ਅਤੇ ਮੇਰਾ ਉਹ ਠੀਕ ਕੀਤਾ ਜਾਵੇ ਠੀਕ ਕਰਕੇ ਮੇਰੇ ਪਤੇ 'ਤੇ ਘੱਲਿਆ ਜਾਵੇ ਮੇਰਾ ਨਾਂਉ ਹੈਗਾ ਗੁਰਮੀਤ ਕੌਰ ਤਲਵੰਡੀ ਪੱਤੀ ਅੱਠ ਨੰਬਰ ਵਾਰਡ ਜੀਤੇ ਡਾਕਟਰ ਦੇ ਘਰ ਦੇ ਕੋਲ ਹੈ ਅਤੇ ਮੇਰਾ ਬਿਲ ਮੇਰੇ ਅੰਦਰ ਸੁੱਟ ਜਿਆ ਕਰਨ ਜੇ ਮੈਂ ਨਾ ਵੀ ਘਰ ਹੋਵਾਂ ਗਲਤ ਕਿਸੇ ਦੇ ਘਰ ਨਾ ਫੜਾਇਆ ਜਾਵੇ ਮੇਰੇ ਅੰਦਰ ਕਮਰੇ ਅੰਦਰ ਸੁੱਟ ਜਿਆ ਕਰਨ ਮੈਂ ਆਪ ਆ ਕੇ ਚੁੱਕ ਲਿਆ ਕਰੂੰਗੀ ਮੇਰੇ ਅਡਰੈਸ 'ਤੇ ਮੇਰਾ ਬੈੱਲ ਜ਼ਰੂਰ ਬਿਜਲੀ ਦਾ ਬਿਲ ਜ਼ਰੂਰ ਭੇਜ ਦਿਆ ਕਰੋ ਇਹਦੇ 'ਤੇ

ਉਹ ਨਾ ਹੋਵੇ ਵੀ ਕਿਸੇ ਦੇ ਘਰ ਘੱਲ ਦਿਉ ਅਤੇ ਮੈਂ ਲੜਾਈ ਕਰਦੀ ਰਹਿਜਾਂ ਅਤੇ ਮੈਨੂੰ ਨਾ ਮਿਲੇ